ਮੈਂ ਪੰਜਾਬ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਵਾਸੀ ਹਾਂ ਸਾਡੇ ਖੇਤਰ ਵਿੱਚ ਜ਼ਿਆਦਾਤਰ ਹਿੰਦੂ ਜਾਂ ਸਿੱਖ ਧਰਮ ਨੂੰ ਹੀ ਮੰਨਿਆ ਜਾਂਦਾ ਹੈ ਇਸਦਾ ਅਭਿਆਸ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਜੋ ਹਿੰਦੂ ਹਨ ਉਹ ਉਪਵਾਸ ਰੱਖਦੇ ਹਨ ਸੋਮਵਾਰ ਮੰਗਲਵਾਰ ਵੀਰਵਾਰ ਬੁੱਧਵਾਰ ਮਤਲਬ ਕਿ ਹਰ ਦਿਨ ਹੀ ਵੱਧ ਤੋਂ ਵੱਧ ਮੰਦਰ ਜਾਂਦੇ ਹਨ ਅਤੇ ਮੱਥਾ ਟੇਕਦੇ ਹਨ ਸਿੱਖ ਆਪਣੇ ਧਰਮ ਦਾ ਅਭਿਆਸ ਇਸ ਤਰ੍ਹਾਂ ਕਰਦੇ ਹਨ ਕਿ ਉਹ ਗੁਰਦੁਆਰਿਆਂ ਵਿੱਚ ਜਾਂਦੇ ਹਨ ਅਤੇ ਵਾਹਿਗੁਰੂ ਵਾਹਿਗੁਰੂ ਜੀ ਕਰਦੇ ਹਨ ਇਸ ਦਾ ਬਹੁਤ ਹੀ ਚੰਗਾ ਹੁੰਦਾ ਹੈ ਇਸ ਨਾਲ ਗੁਰਦੁਆਰੇ ਅਤੇ ਮੰਦਰ ਵਿੱਚ ਜਾਣ ਨਾਲ ਬੰਦੇ ਦਾ ਮਨ ਵੀ ਪ ਪਵਿੱਤਰ ਰਹਿੰਦਾ ਹੈ ਅਤੇ ਆਤਮਾ ਵੀ ਸ਼ੁੱਧ ਹੋ ਜਾਂਦੀ ਹੈ ਵੈਸੇ ਦੇਖਿਆ ਜਾਵੇ ਤਾਂ ਹਰ ਇੱਕ ਇਨਸਾਨ ਨੂੰ ਆਪਣਾ ਕੋਈ ਨਾ ਕੋਈ ਧਰਮ ਮੰਨ ਕੇ ਉਸ ਨੂੰ ਮੰਨਣਾ ਚਾਹੀਦਾ ਹੈ ਇਸ ਨਾਲ ਤੁਹਾਡਾ ਹਿਰਦੇ ਸਾਫ ਹੁੰਦਾ ਹੈ ਅਤੇ ਤੁਸੀਂ ਗਲਤ ਜਗ੍ਹਾ ਨਹੀਂ ਭਟਕਦੇ ਤੁਹਾਡਾ ਮਨ ਸਹੀ ਦਿਸ਼ਾ ਵਿੱਚ ਲੱਗਿਆ ਰਹਿੰਦਾ ਹੈ ਮੈਂ ਤਾਂ ਇਹੀ ਚਾਹਵਾਂਗਾ ਕਿ ਹਰ ਇੱਕ ਬੰਦਾ ਕੋਈ ਨਾ ਕੋਈ ਧਰਮ ਦਾ ਪਾਲਣ ਕਰੇ ਅਤੇ ਉਸ ਨੂੰ ਮੰਨੇ ਵੱਧ ਤੋਂ ਵੱਧ ਧਰਮ ਹੋਣ ਨਾਲ ਇਹ ਹੋਏਗਾ ਕਿ ਲੁੱਟ ਪਾਟ ਵੀ ਘੱਟ ਹੋਏਗੀ ਅਤੇ ਬੰਦਿਆਂ ਦਾ ਮਨ ਵੀ ਸਿੱਧੇ ਪਾਸੇ ਲੱਗਿਆ ਰਹੇਗਾ